ਨਮਸ਼ਕਾਰ ਭਾਅ ਜੀ ਤੁਹਾਡੇ ਤੋਂ ਮੋਬਾਈਲ ਮ ਮੰਗਵਾਇਆ ਸੀਗਾ ਜੀ ਅਤੇ ਤੁਸੀਂ ਕਿਹਾ ਸੀਗਾ ਵੀ ਛੇ ਅੰਦਰ ਛੇ ਦਿਨਾਂ ਦੇ ਅੰਦਰ ਅੰਦਰ ਡਿਲੀਵਰੀ ਕਰਦੂਗੇ ਪਰ ਤੁਸੀਂ ਫਿਰ ਵੀ ਚਾਰ ਦਿਨ ਦੇ ਅੰਦਰ ਡਿਲੀਵਰੀ ਕਰਤੀ ਜੀ ਅਤੇ ਫੋਨ ਬਹੁਤ ਸੋਹਣਾ ਏ ਜੀ ਅਤੇ ਉਹਦੀ ਕੁਆਲਿਟੀ ਬਹੁਤ ਅੱਛੀ ਆ ਸਕਰੀਨ ਅਤੇ ਚਾਰਜਰ ਵੀ ਬਹੁਤ ਛੇਤੀ ਹੋ ਜਾਂਦੀ ਹੈ ਉਹ ਅਤੇ ਸਪੀਕਰ ਕੁਆਲਿਟੀ ਵਧੀਆ ਜੀ ਜਾਣੀ ਕਿ ਐਪ ਵੀ ਐਨ ਵਧੀਆ ਚੱਲਦਾ ਜੀ ਹੈਂਗ ਨਹੀਂ ਹੁੰਦਾ ਜੀ ਬਾਕੀ ਨੈੱਟ ਵੀ ਵਧੀਆ ਚੱਲਦਾ ਉਹਦੇ ਵਿਚ ਹੋਰ ਜੀ ਬਹੁਤ ਵਧੀਆ ਫੋਨ ਆ ਤੁਸੀਂ ਗਿਫਟ ਵੀ ਬਹੁਤ ਵਧੀਆ ਦਿੱਤਾ ਆ ਤੁਸੀਂ ਹੈਡਫੋਨ ਚਾਰਜਰ ਔਰ ਗਲਾਸ ਕਾਡ ਵੀ ਵਧੀਆ ਦਿੱਤਾ ਏ ਜੀ ਐਨ ਓਕੇ ਐਨ ਫੋਨ ਬਹੁਤ ਵਧੀਆ ਜੀ ਲੁਕਿੰਗ ਬਹੁਤ ਅੱਛੀ ਹੈ ਜੀ ਇਹਦੀ ਸਲਿਮ ਫੋਨ ਹੈ ਐਨ ਜੀ ਐਨ ਠੀਕ ਹੈ ਜੀ ਅਤੇ ਮੇਰੇ ਨਾਲ ਦੇ ਦੋਸਤ ਵੀ ਕਹਿ ਰਹੇ ਸੀਗੇ ਵੀ ਇਹਦੇ ਨਾਲ ਦਾ ਫੋਨ ਜੇ ਕੋਈ ਹੋਰ ਹੋਇਆ ਤਾਂ ਦੱਸੀ ਮੈਨੂੰ ਹਾਂਜੀ ਭਾਅ ਜੀ ਜੇ ਮਖਾਂ ਭਾਅ ਜੀ ਇਹਦੇ ਨਾਲ ਦਾ ਕੋਈ ਹੋਰ ਇਹ ਤੋਂ ਵੀ ਅੱਛਾ ਫੋਨ ਆਇਆ ਨਾ ਤਾਂ ਤੁਸੀਂ ਦੱਸਿਓ ਜੀ ਹਾਂਜੀ ਅਤੇ ਚੱਲਣ ਨੂੰ ਇੰਨਾਂ ਵਧੀਆ ਏ ਜੀ ਹੈਂਗ ਨਹੀਂ ਹੁੰਦਾ ਜੀ ਇੱਕ ਪ੍ਰਸੈਂਟ ਵੀ ਓਕੇ ਭਾਅ ਜੀ ਧੰਨਵਾਦ ਜੀ ਜੇ ਇੱਦਾਂ ਦਾ ਕੋਈ ਹੋਰ ਇਹ ਤੋਂ ਵਧੀਆ ਫੋਨ ਹੋਇਆ ਤਾਂ ਮੈਨੂੰ ਦੱਸਿਓ ਜੀ ਠੀਕ ਆ ਭਾਅ ਜੀ ਧੰਨਵਾਦ ਜੀ